ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜੇ ਅਸੀਂ ਆਪਣੇ ਭਾਰਤ ਸਿਹਤ ਸੰਭਾਲ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਹ ਸਾਡੇ ਭਾਰਤ ਵਿੱਚ ਬਹੁਤ ਹੀ ਘੱਟ ਸੁਵਿਧਾਵਾਂ ਹਨ ਦੇਖੋ ਅਸੀ ਇਹੀ ਕਹਿੰਦੇ ਹਾਂ ਕਿ ਸਾਡੇ ਭਾਰਤ ਵਿੱਚ ਨਾ ਤਾਂ ਕੋਈ ਚੰਗੇ ਹਸਪਤਾਲ ਹਨ ਨਾ ਹੀ ਕੋਈ ਅੱਛੀਆਂ ਮਸ਼ੀਨਾਂ ਹਨ ਜਿਸ ਨਾਲ ਅਸੀਂ ਆਪਣਾ ਇਲਾਜ ਕਰਵਾ ਸਕੀਏ ਅਤੇ ਇਹ ਦੂਜੇ ਦੇਸ਼ਾਂ ਦੀ ਤੁਲਨਾ ਕਰੀਏ ਤਾਂ ਤਾਂ ਇਹ ਬਹੁਤ ਹੀ ਪਿੱਛੇ ਹੈ ਦੂਸਰੇ ਦੇਸ਼ਾਂ ਵਿੱਚ ਇੰਨੀਆਂ ਕੁ ਮਸ ਮਸ਼ੀਨਾਂ ਹਨ ਕਿ ਉਹ ਬਹੁਤ ਹੀ ਅੱਛੇ ਢੰਗ ਨਾਲ ਇਲਾਜ ਕਰਦੇ ਹਨ ਦੂਜੇ ਦੇਸ਼ਾਂ ਵਿੱਚ ਇੰਨੇ ਅੱਛੇ ਡਾਕਟਰ ਪੜ੍ਹੇ ਲਿਖੇ ਹਨ ਕਿ ਉਹ ਮਰੀਜ਼ਾਂ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸਾਡੇ ਭਾਰਤ ਵਿੱਚ ਤਾਂ ਇੰਨੀ ਹੀ ਮੁਸ਼ਕਿਲ ਹੈ ਕਿ ਅਸੀਂ ਆਪਣੇ ਕੋਈ ਵੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ ਜੇ ਅਸੀਂ ਆਪਣੇ ਆਲੇ ਦੁਆਲੇ ਦੇ ਹਸਪਤਾਲਾਂ ਦੀ ਗੱਲ ਕਰਦੇ ਹਾਂ ਜਾਂ ਕਲੀਨਿਕ ਦੀ ਗੱਲ ਕਰਦੇ ਹਾਂ ਤਾਂ ਉਹ ਤਾਂ ਬਹੁਤ ਹੀ ਖਰਾਬ ਹਨ ਉਹਨਾਂ ਦੀ ਹਾਲਤ ਇੰਨੀ ਕੁ ਖਰਾਬ ਹੈ ਕਿ ਸਾਨੂੰ ਕੋਈ ਵੀ ਅੱਛੀਆਂ ਤਰ੍ਹਾਂ ਦਾ ਕੋਈ ਕਲੀਨਿਕ ਨਹੀਂ ਮਿਲਦਾ ਜੇ ਕਦੇ ਕਿਤੇ ਅਸੀਂ ਆਪਣੇ ਹਸਪਤਾਲ ਜਾਂ ਪਿੰਡ ਤਾਂ ਜਾਂਦੇ ਹਾਂ ਅਤੇ ਅਸੀਂ ਆਪਣੇ ਟੈਸਟ ਕਰਵਾਉਣਾ ਹੁੰਦਾ ਹੈ ਤਾਂ ਉਹਨਾਂ ਵਿੱਚ ਅੱਛੀ ਮਸ਼ੀਨ ਨਹੀਂ ਹੁੰਦੀ ਜੇ ਅਸੀ ਟੈੱਸਟ ਕਰਾਉਂਦੇ ਹਾਂ ਤਾਂ ਰਿਪੋਰਟ ਸਹੀ ਨਹੀਂ ਆਉਦੀ ਜਦੋਂ ਅਸੀਂ ਉਹ ਰਿਪੋਰਟ ਡਾਕਟਰ ਨੂੰ ਦਿਖਾਉਂਦੇ ਹਾਂ ਤਾਂ ਉਹ ਰਿਪੋਰਟ ਵਿੱਚ ਕੋਈ ਨਾ ਕੋਈ ਕਮੀ ਨਿਕਲ ਜਾਂਦੀ ਹੈ ਜੇ ਅਸੀਂ ਆਪਣੀ ਇਹ ਚੁਨੌਤੀਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਬੜੀ ਬੜੀ ਦੇਰ ਤੱਕ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗੇ ਰਹਿਣਾ ਪੈਂਦਾ ਹੈ ਜਿਸ ਨਾਲ ਸਾਡਾ ਸਮਾਂ ਬੜਾ ਹੀ ਬਰਬਾਦ ਹੁੰਦਾ ਹੈ ਜੇ ਸਵੱਛਤਾ ਦੀ ਗੱਲ ਕਰਦੇ ਹਾਂ ਤਾਂ ਸਾਫ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਸਫਾਈ ਕਰਮਚਾਰੀ ਸਵੇਰੇ ਹੀ ਆਉਂਦੇ ਹਨ ਅਤੇ ਉਹ ਸਫਾਈ ਕਰਕੇ ਚਲੇ ਜਾਂਦੇ ਹਨ ਅਤੇ ਅੱਛੀ ਤਰ੍ਹਾਂ ਸਫਾਈ ਨਹੀਂ ਕਰਦੇ ਅਤੇ ਬਹੁਤ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਜਿਸ ਕਾਰਨ ਸਾਨੂੰ ਆਪਣੀ ਅੱਛੀ ਸੁਵਿਧਾ ਨਹੀਂ ਮਿਲਦੀ ਅਸੀਂ ਇਸ ਸ਼ੇ ਸੇਵਾ ਤੋਂ ਵੰਚਿਤ ਹਾਂ ਇਹਨਾਂ ਦਾ ਸੁਧਾਰ ਜੇ ਅਸੀਂ ਗੱਲ ਕਰਦੇ ਹਾਂ ਕਿ ਸੁਧਾਰ ਕੀ ਕਰਨਾ ਚਾਹੀਦਾ ਹੈ ਸਾਡੀ ਤੁਹਾਡੇ ਅੱਗੇ ਇਹੋ ਅਪੀਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਸਦਾ ਅੱਛੀ ਤਰ੍ਹਾਂ ਸੁਧਾਰ ਕੀਤਾ ਜਾਵੇ ਜ਼ਿਆਦਾ ਨਾ ਮੰਗਦੇ ਹੋਏ ਥੋੜ੍ਹੀ ਜਿਹੀ ਫੈਸਿਲਿਟੀ ਦਿੱਤੀ ਜਾਵੇ ਜਿਸ ਕਾਰਨ ਅਸੀ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਚੰਗੀ ਤਰ੍ਹਾਂ ਇਲਾਜ ਕਰਵਾ ਸਕੀਏ ਅਤੇ ਆ ਸਾਡਾ ਜਿਹੜਾ ਭਾਰਤ ਹੈ ਉਹ ਵੀ ਸਿਹਤ ਸੰਭਾਲ ਪ੍ਰਣਾਲੀ ਦਾ ਇੱਕ ਅੱਛਾ ਅੰਗ ਬਣ ਸਕੇ